ਹਾਂ ਅਸੀਂ ਭੰਗੜੇ ਵਿੱਚ ਵੀ ਐਥਨਿਕ ਮੁਕਾਬਲੇ ਦੇ ਫਾਰਮੈਟ ਨੂੰ ਆਮ ਜ਼ਿੰਦਗੀ ਵਿੱਚ ਸ਼ਾਮਿਲ ਕਰ ਸਕਦੇ ਹਾਂ ਭੰਗੜਾ ਇੱਕ ਜੋਰਦਾਰ ਅਤੇ ਉਤਸ਼ਾਹ ਭਰਿਆ ਨਾਚ ਹੈ ਜੋ ਨਾ ਸਿਰਫ ਮਨੋਰੰਜਨ ਲਈ ਕੀਤਾ ਜਾਂਦਾ ਹੈ ਬਲਕਿ ਇਹ ਇੱਕ ਮੁਕਾਬਲੇ ਦੀ ਭਾਵਨਾ ਨੂੰ ਵੀ ਦਰਸ਼ਾਉਂਦਾ ਹੈ ਨੰਬਰ ਇੱਕ ਭੰਗੜੇ ਮੁਕਾਬਲੇ ਜਿਵੇਂ ਕਿ ਵਿਦਿਆਰਥੀਆਂ ਦੇ ਲਈ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਭੰਗੜੇ ਦੇ ਮੁਕਾਬਲੇ ਹੁੰਦੇ ਹਨ ਅਸੀਂ ਆਮ ਜੀਵਨ ਵਿੱਚ ਵੀ ਇਸ ਤਰੀਕੇ ਨੂੰ ਵਰਤ ਸਕਦੇ ਹਾਂ ਕੰਮ ਕਾਜੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਤੰਦਰੁਸਤ ਰਹਿਣ ਲਈ ਭੰਗੜਾ ਵਰਗੀਆਂ ਵਿਆਮ ਗਤੀਵਿਧੀਆਂ ਨਾਲ ਕਰ ਸਕਦੇ ਹਨ ਨੰਬਰ ਦੋ ਸ਼ਹਿਰੀ ਭੰਗੜਾ ਕਈ ਵਾਰ ਸ਼ਹਿਰਾਂ ਵਿੱਚ ਜਾਂ ਵਿਸ਼ੇਸ਼ ਤਿਉਹਾਰਾਂ 'ਤੇ ਲੋਕ ਰਸਤਾ ਜਾਂ ਮੈਦਾਨਾਂ ਵਿੱਚ ਗਾਣਿਆਂ ਦੇ ਗਾਣਿਆਂ 'ਤੇ ਭੰਗੜਾ ਪਾਉਂਦੇ ਹਨ ਇਹ ਵੀ ਇੱਕ ਤਰੀਕਾ ਹੈ ਜਿੱਥੇ ਲੋਕ ਆਮ ਦਿਨ ਵਿੱਚ ਭੰਗੜੇ ਦੇ ਮੁਕਾਬਲੇ ਵਾਲੀ ਭਾਵਨਾ ਲਿਆਉਂਦੇ ਹਨ ਜਿੱਥੇ ਹਰ ਵਿਅਕਤੀ ਆਪਣੀ ਕਲਾ ਪ੍ਰਦਰਸ਼ਨੀ ਨਾਲ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਫਿਟਨੈਸ ਅਤੇ ਭੰਗੜਾ ਅੱਜ ਕੱਲ੍ਹ ਕਈ ਜਿੰਮ ਅਤੇ ਡਾਂਸ ਸੈਂਟਰ ਭੰਗੜਾ ਫਿਟਨੈਸ ਨੂੰ ਇੱਕ ਮੁਕਾਬਲੇ ਵਾਰ ਤਰੀਕੇ ਨਾਲ ਉਤਸਾਹਿਤ ਕਰਦੇ ਹਨ ਜਿੱਥੇ ਲੋਕ ਭੰਗੜੇ ਦੇ ਸਟੈਪਸ ਨਾਲ ਵਿਆਮ ਕਰਦੇ ਹਨ ਇਹ ਸਾਡੇ ਸਰੀਰ ਨੂੰ ਫਿਟ ਰੱਖਣ ਦੇ ਨਾਲ ਨਾਲ ਸਾਡੇ ਵਿੱਚ ਮੁਕਾਬਲੇ ਵੀ ਮੁਕਾਬਲੇ ਦੀ ਭਾਵਨਾ ਵੀ ਜਨਮ ਦਿੰਦਾ ਹੈ ਭੰਗੜੇ ਦੇ ਪ੍ਰੈਕਟਿਸ ਕਰਦੇ ਸਮੇਂ ਵੀ ਵਿਦਿਆਰਥੀ ਜਾਂ ਟੀਮ ਮੈਂਬਰ ਆਪਸ ਵਿੱਚ ਮੁਕਾਬਲਾ ਕਰਦੇ ਹਨ ਜਿੱਥੇ ਹਰ ਕੋਈ ਚਾਹੁੰਦਾ ਹੈ ਕਿ ਉਹ ਸਭ ਤੋਂ ਵਧੀਆ ਨੱਚੇ ਇਹ ਮੁਕਾਬਲੇ ਦੀ ਆਤਮਾ ਨੂੰ ਆਮ ਜੀਵਨ ਵਿੱਚ ਸ਼ਾਮਿਲ ਕਰਦਾ ਹੈ ਸਮਾਜਿਕ ਮੰਚ 'ਤੇ ਭੰਗੜਾ ਅੱਜ ਕੱਲ੍ਹ ਟਿਕਟੋਕ ਇੰਸਟਾਗ੍ਰਾਮ ਅਤੇ ਯੂਟੀਊਬ ਵਰਗੇ ਪਲੇਟਫਾਰਮ 'ਤੇ ਲੋਕ ਆਪਣੇ ਭੰਗੜੇ ਦੇ ਵੀਡੀਓ ਪੋਸਟ ਕਰਦੇ ਹਨ ਇਹ ਵੀ ਇੱਕ ਤਰੀਕਾ ਹੈ ਜਿੱਥੇ ਲੋਕ ਆਪਸ ਵਿੱਚ ਮੁਕਾਬਲਾ ਕਰਦੇ ਹਨ ਜਿਸ ਵਿੱਚ ਉਹ ਬਿਹਤਰ ਡਾਂਸ ਅਤੇ ਨਵੀਆਂ ਚਾਲਾਂ ਵਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਇਸ ਤਰ੍ਹਾਂ ਭੰਗੜਾ ਸਿਰਫ ਇੱਕ ਨਾਚ ਨਹੀਂ ਬਲਕਿ ਇਹ ਮੁਕਾਬਲੇ ਦੀ ਇੱਕ ਤਕਨੀਕ ਹੈ ਜੋ ਸਾਨੂੰ ਤੰਦਰੁਸਤ ਖੁਸ਼ ਅਤੇ ਆਤਮ ਵਿਸ਼ਵਾਸੀ ਬਣਾਉਂਦੀ ਹੈ ਅਸੀਂ ਆਪਣੇ ਆਮ ਜੀਵਨ ਵਿੱਚ ਇਸ ਮੁਕਾਬਲੇ ਦੀ ਭਾਵਨਾ ਨੂੰ ਸ਼ਾਮਿਲ ਕਰਕੇ ਨਵੀਂ ਉਤਸ਼ਾਹ ਅਤੇ ਉਰਜਾ ਪ੍ਰਾਪਤ ਕਰ ਸਕਦੇ ਹਾਂ